ਸਾਡੇ ਖੇਤਰ ਵਿੱਚ ਅਕਸਰ ਹੀ ਬਹੁਤ ਸਾਰੇ ਪੰਛੀ ਦੇਖੇ ਜਾਂਦੇ ਹਨ ਜਿਨ੍ਹਾਂ ਵਿੱਚ ਕਾਂ ਵੀ ਹੈ ਕਬੂਤਰ ਹੈ ਘੁੱਗੀ ਹੈ ਚਿੜੀ ਹੈ ਕਾਂ ਹੈ ਗੁਟਾਰ ਹੈ ਇਹ ਪੰਛੀ ਸਾਡੇ ਇੱਥੇ ਦੇਖਣ ਨੂੰ ਮਿਲਦੇ ਹਨ ਪਰ ਘਾਟੇ ਦੀ ਗੱਲ ਇਹ ਹੈ ਕਿ ਇਹ ਪੰਛੀ ਦਿਨੋਂ ਦਿਨ ਹੀ ਸਾਡੀਆਂ ਰੈਡੀਟੇਸ਼ਨ ਤਾਰਾਂ ਤਰੰਗਾਂ ਦਾ ਕਰਕੇ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਦਿਨੋਂ ਦਿਨ ਹੀ ਘਟਦੇ ਜਾ ਰਹੇ ਹਨ ਜੋ ਇੱਕ ਬਹੁਤ ਆਉਣ ਵਾਲੇ ਸਮੇਂ ਦਾ ਮਾੜਾ ਸੰਕੇਤ ਦੇ ਰਹੇ ਹਨ ਬਾਕੀ ਜੋ ਸਾਨੂੰ ਪੰਛੀ ਚੰਗੇ ਲੱਗਦੇ ਹਨ ਉਹਨਾਂ ਵਿੱਚੋਂ ਮੋਰ ਪੰਛੀ ਸਾਨੂੰ ਬਹੁਤ ਚੰਗਾ ਲੱਗਦਾ ਹੈ ਜੋ ਕਿ ਨਹਿਰਾਂ ਦੇ ਕੰਢਿਆਂ 'ਤੇ ਅਤੇ ਜੰਗਲਾਂ ਵਿੱਚ ਰਹਿੰਦੇ ਹਨ ਉਹ ਸਾਡੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਹੁਚਾਉਂਦੇ ਉਹ ਕੀੜੇ ਮਕੌੜੇ ਖਾ ਕੇ ਅਤੇ ਆਪਣਾ ਪੇਟ ਭਰ ਲੈਂਦੇ ਹਨ ਅਤੇ ਨਾ ਹੀ ਕਿਸੇ ਫ਼ਸਲ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਨੁਕਸਾਨ ਪਹੁਚਾਉਂਦੇ ਇਸ ਦੇ ਉਲਟ ਸਗੋਂ ਕਾਂ ਏ ਤੋਤੇ ਜਿਹੜੇ ਹਨ ਉਹ ਜਵਾਰਾਂ ਦਾ ਜਾਂ ਹੋਰ ਫਸਲਾਂ ਦਾ ਬਹੁਤ ਨੁਕਸਾਨ ਫ਼ਲ ਬੂਟਿਆਂ ਦਾ ਕਰਦੇ ਹਨ ਥੈਂਕ ਯੂ